ਜੀ ਹਾਂ ਮੈਂ ਅਜਿਹੀ ਸੰਸਥਾ ਬਾਰੇ ਜਾਣਦੀ ਹਾਂ ਜੋ ਕਿ ਪੇਂਡੂ ਔਰਤਾਂ ਨੂੰ ਸਿੱਖਿਆ ਅਤੇ ਕੰਮ ਪ੍ਰਦਾਨ ਵਿੱਚ ਮਦਦ ਕਰਦੀ ਹੈ ਉਹ ਸੰਸਥਾ ਦਾ ਨਾਮ ਹੈ ਸਵੈ ਰੁਜ਼ਗਾਰ ਯੋਜਨਾ ਜੋ ਕਿ ਸਾਡੇ ਪਿੰਡ ਦੀਆਂ ਔਰਤਾਂ ਨੂੰ ਮੁਰੱਬੇ ਚੱਟਣੀਆਂ ਅਚਾਰ ਬਣਾਉਣ ਵਿੱਚ ਮਦਦ ਕਰਦੀ ਹੈ ਅਤੇ ਉਹ ਵੱਖ ਵੱਖ ਕਮਾਈ ਦੇ ਸਾਧਨ ਬਣਾ ਰਹੀਆਂ ਹਨ ਅਤੇ ਉਹ ਆਪਣੀ ਜ਼ਿੰਦਗੀ ਨੂੰ ਮਾਣ ਨਾਲ ਜਿਊ ਸਕਦੀਆਂ ਹਨ ਜੀ ਹਾਂ ਮੈਂ ਇੱਕ ਸਮਾਜ ਸੇਵਕ ਨੂੰ ਮਿਲੀ ਹਾਂ ਜੋ ਸਾਡੇ ਪੇਂਡੂ ਲੋਕਾਂ ਨੂੰ ਹੁਨਰਮੰਦ ਅਤੇ ਰੁਜ਼ਗਾਰ ਪ੍ਰਾਪਤ ਕਰਦੀ ਹੈ ਜਿਨ੍ਹਾਂ ਨੌਜਵਾਨਾਂ ਵਿੱਚ ਹੁਨਰ ਹੁੰਦਾ ਹੈ ਉਹਨਾਂ ਦੇ ਹੁਨਰ ਨੂੰ ਤਰਾਸਦੀ ਹੈ ਜਿਸ ਦਾ ਨਾਮ ਅਨਮੋਲ ਕਾਤਰਾ ਹੈ ਉਹ ਗਰੀਬ ਅਤੇ ਬੇਸਹਾਰਾ ਲੋਕਾਂ ਦੀ ਵੀ ਮਦਦ ਕਰਦਾ ਹੈ